ਚਾਰ ਅਗਸਤ ਉੱਨੀ ਸੌ ਅਠਾਨਵੇਂ ਅੱਠ ਸਤੰਬਰ ਉੱਨੀ ਸੌ ਛਿਆਨਵੇਂ ਸੋਲ੍ਹਾਂ ਅਪ੍ਰੈਲ ਦੋ ਹਜ਼ਾਰ ਦੋ ਵੀਹ ਜੂਨ ਦੋ ਹਜ਼ਾਰ ਪੰਜ